ਮੈਂ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਿਤ ਹਾਂ ਕਿਉਂਕਿ ਸਾਡਾ ਜੋ ਪਰਿਵਾਰ ਹੈ ਸ਼ੁਰੂ ਤੋਂ ਹੀ ਖੇਤੀਬਾੜੀ ਕਰਦਾ ਰਿਹਾ ਹੈ ਪਰੰਤੂ ਜੇ ਮੈਂ ਇਸ ਦੇ ਮੁਨਾਫੇ ਦੀ ਗੱਲ ਕਰਾਂ ਇਸ ਵਿੱਚ ਫਸਲ ਅਤੇ ਲਾਗਤ ਜ਼ਿਆਦਾ ਆਉਂਦੀ ਹੈ ਪਰੰਤੂ ਮੁਨਾਫਾ ਜਿਹੜਾ ਹੈਗਾ ਉਹ ਬਹੁਤ ਹੀ ਘੱਟ ਹੁੰਦਾ ਹੈ ਅਤੇ ਕਈ ਵਾਰੀ ਤਾਂ ਹੁੰਦਾ ਹੀ ਨਹੀਂ ਹੈ ਜਿਸ ਨਾਲ ਕਿਸਾਨ ਦਿਨ ਪ੍ਰਤੀ ਦਿਨ ਗਰੀਬ ਹੁੰਦਾ ਜਾ ਰਿਹਾ ਕਿਉਂਕਿ ਕਿਸਾਨ ਆਪਣੀ ਮਰਜ਼ੀ ਨਾਲ ਤਾਂ ਫਸਲ ਵੇਚ ਵੀ ਨਹੀਂ ਸਕਦਾ ਉਸਨੂੰ ਫਸਲ ਬੀਜਣ ਤੋਂ ਵੱਢਣ ਤੱਕ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਜੇ ਮੈਂ ਕਹਾਂ ਕਿ ਕਿਸਾਨ ਨਾਲੋਂ ਤਾਂ ਜਿਹੜੇ ਵਿਚਲੇ ਦਲਾਲ ਜਾਂ ਆੜਤੀਏ ਅਤੇ ਦੁਕਾਨਦਾਰ ਨੇ ਉਹ ਕਿਸਾਨਾਂ ਤੋਂ ਬਹੁਤ ਹੀ ਘੱਟ ਮੁੱਲ 'ਤੇ ਫਸਲ ਖਰੀਦਦੇ ਨੇ ਅਤੇ ਬਹੁਤ ਹੀ ਮੁਨਾਫਾ ਵਿੱਚ ਅੱਗੇ ਫਸਲ ਵੇਚਦੇ ਹਨ ਅਤੇ ਉਹ ਪੈਸੇ ਮੈਨੂੰ ਲੱਗਦਾ ਵੱਧ ਕਮਾਉਂਦੇ ਨੇ ਕਿਸਾਨਾਂ ਦੇ ਪੱਲੇ ਫਿਰ ਚਿੰਤਾਵਾਂ ਨਿਰਾਸ਼ਾ ਹੀ ਪੱਲੇ ਪੈਂਦੀਆਂ ਹਨ ਇਹੀ ਕਾਰਨ ਹੈ ਕਿ ਅੱਜ ਕ ਲੋਕ ਕਿਸਾਨੀ ਧੰਦੇ ਨੂੰ ਛੱਡ ਰਹੇ ਹਨ ਅਗਰ ਮੈਂ ਖੇਤੀਬਾੜੀ ਦੀ ਮਹੱਤਤਾ ਦੀ ਗੱਲ ਕਰਾਂ ਤਾਂ ਖੇਤੀ ਦੀ ਬਹੁਤ ਹੀ ਮਹੱਤਤਾ ਹੈ ਕਿਉਂਕਿ ਸਾਡਾ ਦੇਸ਼ ਇੱਕ ਅਨਾਜ ਪ੍ਰਧਾਨ ਦੇਸ਼ ਹੈ ਅਨਾਜ ਤੋਂ ਬਿਨਾਂ ਇਸ ਦੀ ਤਰੱਕੀ ਹੋਣਾ ਅਸੰਭਵ ਹੈ ਇਸ ਲਈ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨੀ ਵੱਲ ਜ਼ਿਆਦਾ ਧਿਆਨ ਦੇਣ ਅਤੇ ਕਿਸਾਨਾਂ ਦੀ ਸਹਾਇਤਾ ਕਰਨ ਤਾਂ ਜੋ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਜਾ ਸਕੇ ਧੰਨਵਾਦ